ਬੀਮਾ ਕਰਦੇ ਸਮੇਂ ਮੇਰੇ ਕੋਲ ਇੱਕ ਸਹਿਕਰਮੀ ਆਇਆ ਅਤੇ ਉਸ ਨੇ ਸਲਾਹ ਮੰਗੀ ਤਾਂ ਮੈਂ ਉਸਨੂੰ ਬੀਮਾ ਬਾਰੇ ਸਲਾਹ ਦਿੱਤੀ ਉਸ ਦੇ ਤੰਦਰੁਸਤੀ ਲਾਭਾਂ ਦੇ ਬੀਮਾ ਯੋਜਨਾ ਦੀ ਪੜਤੋ ਪੜਚੋਲ ਕੀਤੀ ਇੱਧਰ ਉੱਧਰ ਤੋਂ ਜਾਣਕਾਰੀ ਇਕੱਠੀ ਕਰਕੇ ਉਸਨੂੰ ਸਲਾਹ ਦਿੱਤੀ ਉਸ ਨੂੰ ਵੀ ਮੈਂਬਰਸ਼ਿਪ ਬਣਨ ਲਈ ਕਿਹਾ ਦੱਸਿਆ ਕਿ ਇਸ ਦੀ ਯੋਜਨਾ ਦਾ ਕਿਸ ਤਰ੍ਹਾਂ ਲਾਭ ਲੈ ਸਕਦੇ ਹਾਂ ਅਤੇ ਸਾਨੂੰ ਇਸ ਦਾ ਕਿਸ ਤਰ੍ਹਾਂ ਲਾਭ ਮਿਲ ਸਕਦਾ ਹੈ ਕਿਉਂ ਅਸੀਂ ਬੀਮਾ ਕਰਵਾਉਂਦੇ ਹਾਂ ਤਾਂ ਆਉਣ ਵਾਲੇ ਸਮੇਂ ਵਿੱਚ ਬਾਏ ਚਾਂਸ ਸਾਨੂੰ ਕੋਈ ਹੈਲਥ ਇਸ਼ੂ ਹੋ ਜਾਂਦਾ ਹੈ ਸਾਡੇ ਕੋਲ ਪੈਸੇ ਨਹੀਂ ਹਨ ਤਾਂ ਅਸੀਂ ਇਸ ਬੀਮੇ ਦਾ ਲਾਭ ਉਠਾ ਸਕਦੇ ਹਾਂ ਅਤੇ ਦੂਜਿਆਂ ਨੂੰ ਵੀ ਸਲਾਹ ਇਹੀ ਦਿੰਦੇ ਹਾਂ ਕਿ ਤੁਸੀਂ ਵੀ ਬੀਮਾ ਕਰਵਾਓ ਅਤੇ ਇਸ ਦਾ ਲਾਭ ਉਠਾਓ